ਅੱਠ ਅਗਸਤ ਉੱਨੀ ਸੌ ਨੜਿਨਵੇਂ ਸੱਤ ਸਤੰਬਰ ਉੱਨੀ ਸੌ ਅੱਸੀ ਛੇ ਜਨਵਰੀ ਉੱਨੀ ਸੌ ਬਾਨਵੇਂ ਪੰਦਰਾਂ ਅਗਸਤ ਉੱਨੀ ਸੌ ਚਾਲੀ ਵੀਹ ਮਾਰਚ ਦੋ ਹਜ਼ਾਰ ਬਾਰਾਂ